ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਤੁਸੀਂ ਕਿਥੋਂ ਬੋਲਦੇ ਹੋ ਹਾਂਜੀ ਜੀ ਸਾਡੇ ਸਟੂਡੈਂਟਸ ਨੂੰ ਨਾ ਟਾਈਮਿੰਗ ਵਿੱਚ ਥੋੜੀ ਪ੍ਰੋਬਲਮ ਆ ਰਹੀ ਆ ਹਾਂਜੀ ਮੈਂ ਬੀਐੱਡ ਦੀ ਇੰਚਾਰਜ ਬੋਲ ਰਹੀ ਆਂ ਹਾਂਜੀ ਤੇ ਜੀ ਤੁਹਾਨੂੰ ਦੱਸਣਾ ਸੀ ਕੀ ਤੁਸੀਂ ਟਾਈਮਿੰਗ ਹਾਂਜੀ ਟਾਈਮਿੰਗ ਲੈਕਚਰ ਸ਼ੋਟ ਹੋ ਰਹੇ ਆਂ ਹਾਂਜੀ ਬੱਚਿਆਂ ਨੂੰ ਤੁਹਾਨੂੰ ਬਹੁਤ ਵਾਰੀ ਰਿਕੁਐਸਟ ਕੀਤੀ ਹ ਕਿ ਟਾਈਮ ਸਹੀ ਕਰਵਾਓ ਤੇ ਥੋੜਾ ਧਿਆਨ ਦਿਓ ਤੇ ਟਾਈਮ ਟੇਬਲ ਚੇਂਜ ਕਰੋ

ਹਾਂਜੀ ਤੁਸੀਂ ਜਲਦੀ ਤੋਂ ਜਲਦੀ ਟਾਈਮਿੰਗ ਚੇਂਜ ਕਰਨਾ ਕਿਉਂਕਿ ਬੱਚੇ ਸਾਡੇ ਕੋਲ ਵਾਰ ਵਾਰ ਆ ਰਹੇ ਨੇ ਕਿ ਸਾਡੇ ਲੈਕਚਰ ਸ਼ੋਟ ਹੋ ਰਹੇ ਨੇ ਤੁਸੀਂ ਥੋੜੀ ਟਾਈਮਿੰਗ ਚੇਂਜ ਕਰੋ ਹਾਂਜੀ ਹਾਂਜੀ ਸਿਲੇਬਸ 'ਚ ਬਹੁਤ ਪ੍ਰੋਬਲਮ ਆ ਰਹੀ ਹ ਬੱਚਿਆਂ ਨੂੰ ਕਿਉਂਕਿ ਅੱਗੇ ਉਹਨਾਂ ਦੇ ਇਗਜ਼ਾਮ ਵੀ ਨੇੜੇ ਆ ਰਹੇ ਨੇ ਸਿਲੇਬਸ ਅਜੇ ਉਹਨਾਂ ਦਾ ਬਹੁਤ ਜਿਆਦਾ ਪੈਂਡਿੰਗ ਪਿਆ ਹਾਂਜੀ ਹਾਂਜੀ ਨਹੀਂ ਜੀ ਇਹੀ ਹੈਗੀ ਹ ਤੇ ਬੱਚਿਆਂ ਦਾ ਜੋ ਇੰਗਲਿਸ਼ ਸਿਲੇਬਸ ਬਹੁਤ ਜਿਆਦਾ ਪੈਂਡਿੰਗ ਪਿਆ ਤੁਸੀਂ ਇਹ ਵੀ ਕਰ ਸਕਦੇ ਹੋ ਕਿ ਇੰਗਲਿਸ਼ ਦੇ ਦੋ ਲੈਕਚਰ ਕਰ ਦਿੱਤੇ ਜਾਣ ਹਾਂਜੀ ਹਾਂਜੀ ਕਦੋਂ ਤੱਕ ਤੁਸੀਂ ਚੇਂਜ ਦੱਸੋਗੇ

ਹਾਂਜੀ ਤੁਸੀਂ ਇੱਕ ਹਾਫ ਟਾਈਮ ਤੋਂ ਪਹਿਲਾਂ ਕਰ ਦੇਣਾ ਔਰ ਇੱਕ ਬਾਅਦ ਵਿੱਚ ਕਰ ਦੇਣਾ ਕਿਉਂਕਿ ਬੱਚੇ ਜੇ ਇਕੱਠੇ ਆਉਣਗੇ ਤਾਂ ਥੋੜਾ ਬੋਰਿੰਗ ਵੀ ਹੋ ਸਕਦਾ ਹਾਂਜੀ ਹਾਂਜੀ ਬਹੁਤ ਨੇ ਆਨੇ ਤਾਂ ਹਾਂਜੀ ਹਾਂਜੀ ਤੁਸੀਂ ਮੈਨੂੰ ਹਾਂਜੀ

ਹਾਂਜੀ ਬੱਚਿਆਂ ਨੂੰ ਬਹੁਤ ਜਿਆਦਾ ਪ੍ਰੋਬਲਮ ਆ ਰਹੀ ਐ ਹਾਂਜੀ ਜਰੂਰ ਠੀਕ ਐ ਜੀ